ਅੱਜ ਕੱਲ੍ਹ ਦੇ ਸਮੇਂ ਚ ਗੂਗਲ ਮੈਪਸ ਕਾਫੀ ਕਾਰਾਗਾਰ ਸਾਬਿਤ ਹੁੰਦੇ ਹਨ ਜਿਵੇਂ ਅਸੀਂ ਕਿਸੇ ਨਵੀਂ ਜਗ੍ਹਾ ਜਾਣਾ ਹੋਵੇ ਅਸੀਂ ਗੂਗਲ ਮੈਪਸ 'ਤੇ ਲੋਕੇਸ਼ਨ ਲਗਾ ਕੇ ਆਸਾਨੀ ਨਾਲ ਪਹੁੰਚ ਸਕਦੇ ਹਾਂ ਹੋਰ ਤੇ ਹੋਰ ਜਿਵੇਂ ਕਿਸੇ ਨੇ ਸਾਨੂੰ ਆਪਣੇ ਸਥਾਨ 'ਤੇ ਬੁਲਾਇਆ ਹੋਵੇ ਤਾਂ ਉਹ ਆਪਣੀ ਲਾਈਵ ਜਾਂ ਕਰੰਟ ਲੋਕੇਸ਼ਨ ਭੇਜ ਕੇ ਸਾਡਾ ਸਫ਼ਰ ਸੌਖਾ ਕਰ ਸਕਦਾ ਹੈ ਪਰ ਕਦੀ ਕਦੀ ਇੱਦਾਂ ਵੀ ਹੁੰਦਾ ਹੈ ਜਿਵੇਂ ਲੋਕੇਸ਼ਨ ਟਰੈਕ ਕਰਨ 'ਚ ਮੁਸ਼ਕਿਲ ਆ ਜਾਂਦੀ ਹੈ ਗਲੀਆਂ 'ਚ ਘੁੰਮਦੇ ਘੁੰਮਦੇ ਲੋਕੇਸ਼ਨ ਕਈ ਵਾਰ ਸਹੀ ਰਾਹ ਨਹੀਂ ਦਿਖਾ ਪਾਉਂਦੀ ਅਤੇ ਗਲਤ ਰਾਹ ਵਿੱਚ ਪਾ ਦਿੰਦੀ ਹੈ ਜਿਹਦੇ ਕਰਕੇ ਪਰੇਸ਼ਾਨੀ ਹੁੰਦੀ ਹੈ ਸੋ ਇਸ ਤਰ੍ਹਾਂ ਗੂਗਲ ਮੈਪਸ ਜ਼ਿਆਦਾਤਰ ਅਤੇ ਸਹੀ ਹੁੰਦਾ ਹੈ ਧੰਨਵਾਦ